ਖੇਤੀਬਾੜੀ ਕਰਨ ਲਈ ਧਰਤੀ ਹੇਠਲਾ ਪਾਣੀ ਸਿੰਜਾਈ ਲਈ ਵਰਤਿਆਂ ਜਾਂਦਾ ਅਤੇ ਇਸ ਤੋਂ ਇਲਾਵਾ ਨਹਿਰਾਂ ਅਤੇ ਦਰਿਆਵਾਂ ਦਾ ਪਾਣੀ ਵੀ ਸਿੰਜਾਈ ਦੇ ਲਈ ਵਰਤਿਆਂ ਜਾਂਦਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਖੇਤੀਬਾੜੀ ਵਿੱਚ ਝੋਨੇ ਦੀ ਫਸਲ ਉਗਾਈ ਜਾਂਦੀ ਹੈ ਅਤੇ ਝੋਨਾ ਉਹ ਫਸਲ ਹੈ ਜੋ ਸਭ ਤੋਂ ਵਧੇਰੇ ਪਾਣੀ ਖਾਂਦੀ ਹੈ ਜਿਸ ਕਾਰਨ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਦਰਿਆਵਾਂ ਅਤੇ ਕੱਸੀਆਂ ਦਾ ਪਾਣੀ ਹੈ ਜੋ ਉਹ ਵਧੇਰੇ ਖੇਤਰ ਤੱਕ ਨਹੀਂ ਪਹੁੰਚਦਾ ਜਿਸ ਕਾਰਨ ਵਧੇਰੇ ਖੇਤਰਾਂ ਦੇ ਵਿੱਚ ਟਿਊਬਵੈਲ ਹੀ ਪਾਣੀ ਦੇ ਸਰੋਤ ਵਜੋਂ ਕੰਮ ਕਰਦੇ ਹਨ ਝੋਨੇ ਦੀ ਫਸਲ ਕਾਰਨ ਪਾਣੀ ਹੇਠਾਂ ਜਾਣ ਕਾਰਨ ਟਿਊਬਵੈਲ ਲਗਾਤਾਰ ਨਵੇਂ ਨਵੇਂ ਲਗਵਾਉਣੇ ਪੈਂਦੇ ਹਨ ਜਿਸ ਦਾ ਕਿ ਬਹੁਤ ਸਾਰਾ ਖਰਚਾ ਖੇਤੀਬਾੜੀ ਕਰਦੇ ਹੋਏ ਕਿਸਾਨਾਂ ਦੇ ਉੱਤੇ ਪੈਂਦਾ ਹੈ ਅਤੇ ਉਹ ਲਗਾਤਾਰ ਕਰਜ਼ੇ ਦੀ ਮਾਰ ਹੇਠ ਡੁੱਬਦੇ ਜਾ ਰਹੇ ਹਨ ਖੇਤੀਬਾੜੀ ਚੰਗੀ ਤਰ੍ਹਾਂ ਹੋ ਸਕੇ ਇਸ ਦੇ ਲਈ ਵਿਭਿੰਨ ਪ੍ਰਕਾਰ ਦੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਅਤੇ ਪਾਣੀ ਦੀ ਬੂੰਦ ਬੂੰਦ ਬਚਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਮਨੁੱਖਤਾ ਦੇ ਲਈ ਇਸ ਨੂੰ ਚੰਗੇ ਰੂਪ ਦੇ ਵਿੱਚ ਵਰਤਿਆ ਜਾ ਸਕੇ